ਹੈਲੋ ਹਾਂਜੀ ਹਾਂਜੀ ਬੋਲੋ ਸਤਿ ਸ਼੍ਰੀ ਅਕਾਲ ਹਾਂਜੀ ਹਾਂਜੀ ਉੱਥੋਂ ਦੀ ਓਨਰ ਹੀ ਹਾਂ ਬੋਲੋ ਹਾਂਜੀ ਹੋਰ ਗਰੈਜੂਏਸ਼ਨ ਫਸਟ ਈਅਰ ਦੀਆਂ ਕਿਹੜੀਆਂ ਕਿਹੜੀਆਂ ਬੁੱਕਸ ਲੈਣੀਆਂ ਸੀ

ਹਾਂਜੀ ਹਾਂਜੀ ਮਿਲ ਜਾਣੀ ਗਈਆਂ ਫਸਟ ਹੈਂਡ ਲੈਣੀਆਂ ਨੇ ਕਿ ਸੈਕਿੰਡ ਹਾਂ ਕੁਛ ਕੁ ਬੁੱਕਸ ਹੈਗੀਆਂ ਨੇ ਸੈਕਿੰਡ ਹੈਂਡ ਅਵੇਲੇਬਲ ਅਤੇ ਕੁਛ ਕੁ ਤੁਹਾਨੂੰ ਨਿਊ ਹੀ ਮਿਲਣਗੀਆਂ ਮੈਥ ਦੀਆਂ ਬੁੱਕਸ ਅਵੇਲੇਬਲ ਹੈਗੀਆਂ ਕੰਪਿਊਟਰ ਦੀਆਂ ਨਹੀਂ

ਸੈਕਿੰਡ ਹੈਂਡ ਬੁੱਕਸ ਜਿਵੇਂ ਕੋਈ ਬੁੱਕ ਤਿੰਨ ਸੌ ਦੀ ਆ ਤਾਂ ਉਹ ਤੁਹਾਨੂੰ ਦੋ ਸੌ ਦੀਆਂ ਕੁਝ ਮਿਲ ਜਾਵੇਗੀ ਕਿਹੜੀ ਕਲਾਸ ਦੀਆਂ ਅੱਛਾ ਉਹਦੀਆਂ ਠੀਕ ਹੈ ਆਰਟਸ ਦੀਆਂ ਜਾਂ ਸਾਇੰਸ ਦੀਆਂ ਠੀਕ ਹੈ ਅ ਬੁੱਕ ਦੀ ਕੰਡੀਸ਼ਨ ਕਿੱਦਾਂ ਹਾਂ ਉਹ ਕੰਡੀਸ਼ਨ ਦੇ ਉੱਤੇ ਡਿਪੈਂਡ ਹੈ ਦੇਖ ਲਾਂਗੇ ਅਗਰ ਸਾਨੂੰ ਸਹੀ ਲੱਗਾ ਕਿ ਅਸੀਂ ਲੈ ਸਕਦੇ ਹਾਂ ਬੁੱਕਸ ਤਾਂ ਤੁਹਾਨੂੰ ਫਿਰ ਉਸ ਹਿਸਾਬ ਨਾਲ ਪੈਸੇ ਵੀ ਦੇ ਦਾਂਗੇ ਉਸ ਬੁੱਕਸ ਦੇ ਹਾਂ ਤੁਸੀਂ ਮੈਨੂੰ ਨਾ ਬੁੱਕਸ ਦੀ ਕੰਡੀਸ਼ਨ ਦਿਖਾ ਦਿਓ ਕਿੱਦਾਂ ਹੈ ਜੇ ਤੁਸੀਂ ਆਪਣੀਆਂ ਪੁਰਾਣੀਆਂ ਬੁੱਕਸ ਮੋੜਨੀਆਂ ਤਾਂ ਅਤੇ ਫਿਰ ਹਾਂਜੀ ਹਾਂਜੀ ਅਤੇ ਵੈਸੇ ਤਾਂ ਇੱਦਾਂ ਕੋਸ਼ਿਸ਼ ਕਰੋ ਕਿ ਅੱਜ ਹੀ ਆ ਜਾਓ ਕਿਉਂਕਿ ਉਹ ਗ੍ਰੈਜੂਏਸ਼ਨ ਦੀਆਂ ਬੁੱਕਸ ਬਹੁਤ ਬੱਚੇ ਲੈ ਕੇ ਜਾ ਰਹੇ ਆ ਅਤੇ ਫਿਰ ਲਿਮਿਟਿਡ ਬੁੱਕਸ ਰਹਿ ਗਈਆਂ ਨੇ ਅਤੇ ਅਗਰ ਤੁਸੀਂ ਲੈ ਕੇ ਜਾਣੀਆਂ ਤਾਂ ਅੱਜ ਲੈ ਜਾਓ ਬਾਅਦ ਵਿੱਚ ਫਿਰ ਸਾਰੇ ਬੱਚੇ ਲੈ ਗਏ ਤਾਂ ਫਿਰ ਤੁਹਾਨੂੰ ਔਖਾ ਹੋ ਜੂਗਾ ਹਾਂਜੀ ਹਾਂਜੀ ਨਾਵਲ ਕਿਹੜੇ ਕਿਹੜੇ ਪੰਜਾਬੀ ਨਾਵਲ ਹਾਂ ਅਵੇਲੇਬਲ ਹੈਗੇ ਆ ਤੁਸੀਂ ਕੋਈ ਨਹੀਂ ਮੈਨੂੰ ਡਿਟੇਲ ਦੱਸ ਦਿਓ ਆਣ ਕੇ ਤਾਂ ਫਿਰ ਆਪਾਂ ਕੋਈ ਨਹੀਂ ਦੇਖ ਲਵਾਂਗੇ ਅਗਰ ਅਵੇਲੇਬਲ ਹੋਈ ਤਾਂ ਤੁਹਾਨੂੰ ਦੇ ਦੇਵਾਂਗੇ

ਹਾਂਜੀ ਕੋਸ਼ਿਸ਼ ਕਰਿਓ ਕਿ ਅੱਜ ਆ ਜਾਇਓ ਮੁੜ ਕੇ ਫਿਰ ਬਾਅਦ ਵਿੱਚ ਔਖਾ ਹੋ ਜੂਗਾ ਮੁੜ ਕੇ ਫਿਰ ਫਸਟ ਹੈਂਡ ਮਿਲਣਗੀਆਂ ਸੈਕਿੰਡ ਹੈਂਡ ਤਾਂ ਲਿਮਿਟਿਡ ਹੀ ਰਹਿ ਗਈਆਂ ਹਾਂਜੀ ਹਾਂਜੀ ਚਲੋ ਕੋਈ ਨਹੀਂ ਆ ਜਾਇਓ ਤੁਸੀਂ ਠੀਕ ਹੈ